ਬਾਈ ਜੁਲਾਈ ਦੋ ਹਜ਼ਾਰ ਚੌਵੀ ਇੱਕੀ ਜੂਨ ਦੋ ਹਜ਼ਾਰ ਤੇਈ ਗਿਆਰਾਂ ਨਵੰਬਰ ਦੋ ਹਜ਼ਾਰ ਬਾਈ ਦਸ ਅਕਤੂਬਰ ਦੋ ਹਜ਼ਾਰ ਇੱਕੀ ਗਿਆਰਾਂ ਅਕਤੂਬਰ ਦੋ ਹਜ਼ਾਰ ਬਾਈ